ਮੈਂ ਹਿਮਾਚਲ ਪ੍ਰਦੇਸ਼ ਗਿਆ ਹਾਂ ਅਤੇ ਉੱਥੇ ਦੇ ਮੈਨੂੰ ਬੜੇ ਪਹਾੜ ਬੜੇ ਪਸੰਦ ਆ ਅਤੇ ਉੱਥੇ ਦਾ ਖਾਣਾ ਮੈਨੂੰ ਬਹੁਤ ਪਸੰਦ ਏ ਆ ਉੱਥੇ ਦੇ ਅਲੱਗ ਹੀ ਆ ਪੰਜਾਬ ਦੇ ਖਾਣੇ ਨਾਲੋਂ ਅਲੱਗ ਲੱਗਦਾ ਏ ਆ ਇਸ ਕਰਕੇ ਮੈਨੂੰ ਉਹ ਪਸੰਦ ਆ ਉੱਥੇ ਦੀਆਂ ਹਵਾਵਾਂ ਠੰਡੀਆਂ ਹਵਾਵਾਂ ਅਤੇ ਉੱਥੇ ਦਾ ਮੌਸਮ ਬਹੁਤ ਵਧੀਆ ਲੱਗਦਾ ਏ ਆ ਮੈਨੂੰ ਤਾਂ ਦਿਲ ਕਰਦਾ ਏ ਕਿ ਮੈਂ ਉੱਥੇ ਹੀ ਰਿਹਾ ਕਰਾਂ ਅਤੇ ਮੈਨੂੰ ਬਹੁਤ ਪਸੰਦ ਆ ਉਹਨਾਂ ਦੀ ਰਹਿਣ ਸਹਿਣ